ਹੈਲੋ ਹੈਲੋ ਹਾਂਜੀ ਕਿੱਥੋਂ ਬੋਲ ਰਹੇ ਹੋ ਹੈਲੋ ਹੈਲੋ ਹੈਲੋ ਹਾਂਜੀ ਤੁਸੀਂ ਕੰਟੀਨ ਹੋਲਡਰ ਹੈਲੋ ਹਾਂਜੀ ਮੈਡਮ ਮੈਂ ਇਹ ਕਹਿਣਾ ਸੀ ਵੀ ਅਸੀਂ ਤੁਹਾਡੀ ਕੰਟੀਨ ਤੋਂ ਜਿਹੜਾ ਵੀ ਸਮਾਨ ਮੰਗਾਉਂਦੇ ਆ ਨਾ ਉਹ ਹਾਈਜੇਨਿਕ ਨਹੀਂ ਹੈਗਾ ਅਤੇ ਉਹਦੇ ਵਿੱਚ ਤੁਸੀਂ ਇੰਪਰੂਵਮੈਂਟ ਕੁਛ ਕਰੋਗੇ ਬਸ ਆਹੀ ਘਰ ਦਾ ਹੀ ਵਰਤਦੇ ਹਾਂ ਆਹੀ ਵੈਸੇ ਅਸੀਂ ਉਹ ਕਿਚਨ ਦਾ ਹੀ ਮੰਗਵਾਇਆ ਸੀ ਸਮਾਨ ਹੈਲੋ ਹੈਲੋ ਕਿਚਨ ਦਾ ਜਿਹੜਾ ਡੇਲੀ ਯੂਜ ਹੁੰਦਾ ਹੈ ਜਿਵੇਂ ਨਮਕ ਮਿਰਚ ਹਲਦੀ ਵਗੈਰਾ ਬਸ ਆਹੀ ਮੰਗਵਾਇਆ ਸੀ ਹਾਂਜੀ ਮਿਰਚ ਦੀ ਕੁਆਲਿਟੀ ਵਧੀਆ ਨਹੀਂ ਹੈਗੀ ਅਤੇ ਹਲਦੀ ਵਗੈਰਾ ਇਨ੍ਹਾਂ ਦੀ ਵੀ ਕੁਝ ਵੀ ਕੁਆਲਿਟੀ ਇੰਨੀ ਚੰਗੀ ਨਹੀਂ ਹੈਗੀ ਅੱਛਾ ਠੀਕ ਠੀਕ ਹੈ ਮੈਮ ਅੱਛਾ ਅਤੇ ਮਤਲਬ ਸਾਰਾ ਰਿਟਰਨ ਹੋਜੇਗਾ ਜਾਂ ਫਿਰ ਮਤਲਬ ਕੁਛ ਤੁਸੀਂ ਆਪਣਾ ਡਿਸਕਾਊਂਟ ਵਗੈਰਾ ਅੱਛਾ ਨਹੀਂ ਅੱਗੇ ਤੋਂ ਬਾਅਦ ਜਿਵੇਂ ਅਸੀਂ ਤੁਹਾਡੇ ਤੋਂ ਹੀ ਲੈਂਦੇ ਹਾਂ ਤਾਂ ਫੇਰ ਉਹਦੀ ਕੁਆਲਟੀ ਵਗੈਰਾ ਉਹਦੇ ਵਿੱਚ ਕੁਛ ਉਹ ਵੀ ਫੇਰ ਦੁਬਾਰਾ ਦਿੱਕਤ ਆਈ

ਅਤੇ ਤੁਸੀਂ ਨਾਲੇ ਕੀ ਕੀ ਕੋਸ਼ਿਸ਼ ਕਰੋਗੇ ਵੀ ਇੰਪਰੂਵਮੈਂਟ ਹੋਜੇ ਇਹਦੇ ਵਿੱਚ ਹਾਂਜੀ ਤੁਸੀਂ ਕੀ ਕੀ ਇਹਦੇ ਵਿੱਚ ਇੰਪਰੂਵਮੈਂਟ ਕਰੋਗੇ

ਅੱਛਾ ਹਾਂ ਉਹ ਵੀ ਦਿੱਕਤ ਆ ਜਾਂਦੀ ਹੈ ਹਾਂਜੀ ਹਾਂਜੀ ਮੈਮ ਚਲ ਠੀ ਠੀਕ ਹੈ ਮੈਮ ਅਸੀਂ ਫੇਰ ਉਹ ਕਰਵਾ ਦੇਵਾਂਗੇ ਅਤੇ ਤੁਸੀਂ ਰੀਫੈਂਡ ਉਹ ਥੋੜ੍ਹਾ ਵੇਖ ਲਿਆ ਜੇ ਹਾਂਜੀ ਠੀਕ ਹੈ ਥੈਂਕ ਯੂ ਮੈਮ